ਸਾਡੇ ਕੋਲ ਕਈ ਫੋਟੋਆਂ ਦੀ ਹਾਰਡ ਕਾਪੀ ਕਲਿੱਕ ਕੀਤੀ ਗਈ ਹੈ ਜਿਵੇਂ ਕਿ ਸਾਡੇ ਮ ਸਾਡੇ ਮਾਪੇ ਅਤੇ ਸਾਡੇ ਦਾਦਿਆਂ ਦੇ ਵਿਆਹਾਂ ਅਤੇ ਹੋਰ ਪ੍ਰੋਗਰਾਮ ਦੀਆਂ ਫੋਟੋਆਂ ਇਹ ਫੋਟੋਆਂ ਅਸੀਂ ਕਈ ਵਾਰ ਦੇਖਦੇ ਹਾਂ ਅਤੇ ਇਹਨਾਂ ਵਿੱਚ ਬਹੁਤ ਹੀ ਜ਼ਿਆਦਾ ਭਾਵ ਭਾਵਨਾਤਮਕ ਮੁੱਲ ਹੁੰਦਾ ਹੈ ਅੱਜ ਕੱਲ੍ਹ ਤਾਂ ਅਸੀਂ ਫੋਨ ਨਾਲ ਵੀ ਬਹੁਤ ਸਾਰੀਆਂ ਫੋਟੋਆਂ ਖਿੱਚ ਸਕਦੇ ਹਨ ਪਰ ਜਿੰਨੀ ਭਾਵਨਾ ਉਸ ਹਾਰਡ ਕਾਪੀ ਵਿੱਚ ਹੁੰਦੀ ਹੈ ਓਨੀ ਫੋਨ ਦੁਆਰਾ ਖਿੱਚੀ ਗਈ ਫੋਟੋ ਵਿੱਚ ਨਹੀਂ ਹੁੰਦੀ ਡਿਜੀਟਲ ਡਿਜੀਟਲ ਫੋਟੋਆਂ ਬਹੁਤ ਹੀ ਜ਼ਿਆਦਾ ਮਹੱਤ ਬਹੁਤ ਹੀ ਜ਼ਿਆਦਾ ਯੂਸਫੁੱਲ ਹਨ ਕਿਉਂਕਿ ਕਿਉਂਕਿ ਇਹ ਅਸੀਂ ਕਿਤੇ ਵੀ ਰੱਖ ਸਕਦੇ ਹਨ ਅਤੇ ਹਰ ਚੀਜ਼ ਵਿੱਚ ਦੇਖ ਸਕਦੇ ਹਨ ਜਿੱਦਾਂ ਆਪਾਂ ਫੋਨ ਵਿੱਚ ਖਿੱਚੀ ਹੋਈ ਫੋਟੋ ਆਪਣੇ ਕੰਪਿਊਟਰ ਟੀ ਵੀ ਜਾਂ ਲੈਪਟੋਪ ਵਿੱਚ ਵੀ ਚਲਾ ਸਕਦੇ ਹਨ ਅਸੀਂ ਇਹਨੂੰ ਕਿਤੇ ਵੀ ਰੱਖ ਸਕਦੇ ਹਨ ਪਰ ਹਾਰਡ ਕਾਪੀ ਨੂੰ ਔਰ ਸਾਨੂੰ ਸੰਜੋਅ ਕੇ ਕਿਸੇ ਜਗ੍ਹਾ ਰੱਖਣਾ ਪੈਂਦਾ ਹੈ ਜਾਂ ਕਿਸੇ ਐਲਬਮ ਵਿੱਚ ਲਗਾਉਣੀ ਪੈਂਦੀ ਹੈ ਨਹੀਂ ਤਾਂ ਉਹ ਖਰਾਬ ਹੋ ਜਾਂਦੀ ਹੈ ਪਰ ਹਾਰਡ ਕਾਪੀ ਹੀ ਭਾਵ ਭਾਵਨਾਤਮਕ ਮੁੱਲ 'ਤੇ ਸਭ 'ਤੇ ਉੱਤੇ ਹੁੰਦੀ ਹੈ ਕਿਉਂਕਿ ਇਸ ਨੂੰ ਦੇਖ ਕੇ ਸਾਡੀਆਂ ਯਾਦਾਂ ਵਾਪਸ ਪੁਰਾਣੀਆਂ ਹੋ ਜਾਂਦੀਆਂ ਹਨ